ਨਮਸਕਾਰ ਜੀ ਮੇਰਾ ਨਾਮ ਪੂਜਾ ਹੈ ਔਰ ਮੈਂ ਪਠਾਨਕੋਟ ਦੀ ਰਹਿਣ ਵਾਲੀ ਹਾਂ ਖੇਤੀ ਵਿੱਚ ਮੇਰਾ ਪਸੰਦੀਦਾ ਪਹਿਲੂ ਇਹ ਹੈ ਕਿ ਸਾਡੇ ਘਰ ਵਿੱਚ ਇੱਕ ਪਲਾਟ ਹੈ ਜਿਸ ਵਿੱਚ ਮੈਂ ਸਬਜ਼ੀਆਂ ਬੀਜਦੀ ਹਾਂ ਔਰ ਮੈਨੂੰ ਸਬਜ਼ੀਆਂ ਬੀਜਣਾ ਬਹੁਤ ਹੀ ਪਸੰਦ ਹੈ ਔਰ ਮੈਂ ਜ਼ਿਆਦਾਤਰ ਆਪਣੇ ਘਰ ਵਿੱਚ ਹੀ ਪਨੀਰੀ ਤਿਆਰ ਕਰਕੇ ਸਬਜ਼ੀਆਂ ਬੀਜਦੀ ਹਾਂ ਜਿਸ ਤਰ੍ਹਾਂ ਕਿ ਮੈਂ ਸਬਜ਼ੀ ਬਣਾਉਂਦੀ ਹਾਂ ਅਤੇ ਸਬਜ਼ੀ ਵਿੱਚ ਹਰ ਇੱਕ ਸਬਜ਼ੀ ਵਿੱਚ ਟਮਾਟਰ ਪੈਂਦੇ ਹਨ ਅਤੇ ਮੈਂ ਜਦੋਂ ਸਬਜ਼ੀ ਬਣਾਉਂਦੀ ਹਾਂ ਤਾਂ ਉਸ ਟਮਾਟਰ ਦੇ ਬੀਜ ਜਿਹੜੇ ਕਿ ਉਹ ਰੱਖ ਲੈਂਦੀ ਹਾਂ ਔਰ ਉਹਦੇ ਵਿੱਚ ਪਾਣੀ ਮਿਕਸ ਕਰਕੇ ਅਤੇ ਮੈਂ ਮਿੱਟੀ ਵਿੱਚ ਸੁੱਟ ਦਿੰਦੀ ਹਾਂ ਉਹਦੇ ਨਾਲ ਸਾਡੀ ਟਮਾਟਰ ਦੀ ਪਨੀਰੀ ਤਿਆਰ ਹੋ ਜਾਂਦੀ ਹੈ ਔਰ ਮੈਂ ਅਲੱਗ ਅਲੱਗ ਜਗ੍ਹਾ 'ਤੇ ਉਸ ਪਨੀਰੀ ਨੂੰ ਲਗਾ ਲੈਂਦੀ ਹਾਂ ਅਤੇ ਇਸ ਤਰ੍ਹਾਂ ਹੀ ਮੈਂ ਮਿਰਚਾਂ ਦੀ ਪਨੀਰੀ ਵੀ ਤਿਆਰ ਕਰਦੀ ਹਾਂ ਮਿਰਚਾਂ ਦੀ ਪਨੀਰੀ ਜਿਸ ਤਰ੍ਹਾਂ ਮੈਂ ਬੀਜ ਸੁੱਟ ਕੇ ਤੇ ਪਨੀਰੀ ਤਿਆਰ ਕਰਦੀ ਹਾਂ ਫੇਰ ਉਹ ਮਿਰਚਾਂ ਦੀ ਪਨੀਰੀ ਅਲੱਗ ਅਲੱਗ ਜਗ੍ਹਾ 'ਤੇ ਲਗਾ ਦਿੰਦੀ ਹਾਂ ਅਤੇ ਉਹ ਵੀ ਮਿਰਚਾਂ ਦੇ ਪੌਦੇ ਤਿਆਰ ਹੋ ਜਾਂਦੇ ਹਨ ਇਸ ਤਰ੍ਹਾਂ ਹਰ ਇੱਕ ਜੈਸ ਜਿੱਦਾਂ ਕਿ ਮੈਂ ਬੈਂਗਣ ਦੀ ਪਨੀਰੀ ਵੀ ਇਸ ਤਰ੍ਹਾਂ ਹੀ ਤਿਆਰ ਕਰਦੀ ਹਾਂ ਜਿਸ ਤਰ੍ਹਾਂ ਮੈਂ ਬਾਜ਼ਾਰ ਵਿੱਚੋਂ ਬੈਂਗਣ ਲਿਆਂਦੇ ਹਨ ਬਣਾਏ ਹਨ ਔਰ ਜਦੋਂ ਅਸੀਂ ਉਹ ਬੈਂਗਣ ਨੂੰ ਮੈਂ ਕੱਟਦੀ ਹਾਂ ਅਤੇ ਉਸਨੂੰ ਵੋਸ਼ ਕਰਨ ਤੋਂ ਬਾਅਦ ਧੋਣ ਤੋਂ ਬਾਅਦ ਜਿਹੜੇ ਉਹਦੇ ਬੀਜ ਰਹਿ ਜਾਂਦੇ ਹਨ ਬਰਤਨ ਵਿੱਚ ਉਹ ਵੀ ਮੈਂ ਪਾਣੀ ਮਿੱਟੀ ਵਿੱਚ ਸੁੱਟ ਦਿੰਦੀ ਹਾਂ ਅਤੇ ਉਹਦੇ ਨਾਲ ਵੀ ਪਨੀਰੀ ਤਿਆਰ ਹੋ ਜਾਂਦੀ ਹੈ ਅਤੇ ਜਿਹੜੀ ਕਿ ਮੈਂ ਅਲੱਗ ਅਲੱਗ ਜਗ੍ਹਾ 'ਤੇ ਲਗਾ ਕੇ ਪਨੀਰੀ ਤਿਆਰ ਕਰਦੀ ਹਾਂ ਅਤੇ ਉਹ ਫੇਰ ਬੈਂਗਣ ਦੇ ਪੌਦੇ ਤਿਆਰ ਹੋ ਜਾਂਦੇ ਹਨ ਮੈਨੂੰ ਆਪਣੇ ਪਲਾਟ ਵਿੱਚ ਸਬਜ਼ੀਆਂ ਲਗਾਉਣ ਦਾ ਬਹੁਤ ਹੀ ਸ਼ੌਕ ਹੈ ਮੈਂ ਅਲੱਗ ਅਲੱਗ ਸਬਜ਼ੀਆਂ ਲਗਾਉਂਦੀ ਹਾਂ ਜਿਸ ਜਿਵੇਂ ਕਿ ਹੁਣ ਗਰਮੀਆਂ ਦਾ ਮੌਸਮ ਹੈ ਮੈਂ ਖੀਰੇ ਤਰਾਂ ਬੈਂਗ ਬੈਂਗਣ ਫੇਰ ਲੌਕੀ ਘੀਆ ਕਰੇਲੇ ਹਰ ਤਰ੍ਹਾਂ ਦੀ ਸਬਜ਼ੀ ਆਪਣੇ ਘਰ ਵਿੱਚ ਲਗਾਈ ਹੈ ਜਿਵੇਂ ਭਿੰਡੀਆਂ ਟਮਾਟਰ ਸਭ ਕੁਛ ਮੈਂ ਆਪਣੇ ਬਗੀਚੇ ਵਿੱਚ ਲਗਾਇਆ ਹੈ ਔਰ ਮੈਨੂੰ ਬਹੁਤ ਹੀ ਅੱਛਾ ਲੱਗਦਾ ਹੈ ਮੈਂ ਜ਼ਿਆਦਾ ਤਾਂ ਜ਼ਿਆਦਾਤਰ ਆਪਣੇ ਪਲਾਟ ਵਿੱਚ ਹੀ ਲੱਗੀ ਰਹਿੰਦੀ ਹਾਂ ਕੁਛ ਨਾ ਕੁਛ ਕਿ ਪੌਦਿਆਂ ਨੂੰ ਕੋਈ ਫੰਗਸ ਨਾ ਲੱਗੇ ਉਹਨਾਂ 'ਤੇ ਟਾਈਮ 'ਤੇ ਟਾਈਮ ਛਿੜਕਾਅ ਕਰਦੀ ਰਹਿੰਦੀ ਹਾਂ ਕਿ ਜ਼ਿਆਦਾ ਟਾਈਮ ਉਸੀ ਜਗ੍ਹਾ ਵਿੱਚ ਬਿਤਾਉਂਦੀ ਹਾਂ ਔਰ ਸਬਜ਼ੀਆਂ ਦੇ ਨਾਲ ਨਾਲ ਮੈਨੂੰ ਫੁੱਲ ਵਗੈਰਾ ਵੀ ਬਹੁਤ ਲਗਾਉਣ ਦਾ ਸ਼ੌਕ ਹੈ ਅਤੇ ਮੈਂ ਚਾਹੁੰਦੀ ਹਾਂ ਕਿ ਮੈਂ ਗਮਲਿਆਂ ਵਿੱਚ ਹਰ ਤਰ੍ਹਾਂ ਦਾ ਫੁੱਲ ਲਗਾਵਾਂ ਮੈਨੂੰ ਕਿ ਇੰਨਾ ਕੁ ਹੀ ਜ਼ਿਆਦਾ ਸ਼ੌਕ ਹੈ ਕਿ ਮੈਂ ਹਰ ਤਰ੍ਹਾਂ ਦਾ ਫੁੱਲ ਜੋ ਵੀ ਫੁੱਲ ਦੇਖਦੀ ਹਾਂ ਮੇਰੇ ਮਨ ਦੀ ਇੱਛਾ ਹੁੰਦੀ ਹੈ ਕਿ ਮੈਂ ਇਹ ਫੁੱਲ ਆਪਣੇ ਘਰ ਲਗਾਵਾਂ ਅਤੇ ਮੈਂ ਹਰ ਤਰ੍ਹਾਂ ਦਾ ਫੁੱਲ ਆਪਣੇ ਘਰ ਲਗਾਉਣਾ ਚਾਹੁੰਦੀ ਹਾਂ ਅਤੇ ਜ਼ਿਆਦਾ ਤੋਂ ਤਾਂ ਜ਼ਿਆਦਾ ਮੇਰੇ ਘਰ ਜੋ ਵੀ ਆਉਂਦੇ ਹਨ ਅਤੇ ਉਹ ਕਹਿੰਦੇ ਕਿ ਤੂੰ ਇਹ ਗਮਲੇ ਕਿਸ ਤਰ੍ਹਾਂ ਤਿਆਰ ਕੀਤੇ ਇਹ ਤੂੰ ਫੁੱਲ ਇੰਨੇ ਸੁੰਦਰ ਕਿੱਥੋਂ ਲਗਾਏ ਜਾਂ ਕਿੱਦਾਂ ਇਹੋ ਜਿਹੀਆਂ ਗੱਲਾਂ ਮੈਨੂੰ ਪੁੱਛਦੇ ਹਨ ਅਤੇ ਮੈਨੂੰ ਬਹੁਤ ਹੀ ਅੱਛਾ ਲੱਗਦਾ ਹੈ ਕਿ ਮੈਂ ਗਮਲੇ ਵੀ ਘਰ ਹੀ ਤਿਆਰ ਕਰਦੀ ਹਾਂ ਜਿਵੇਂ ਕਿ ਹੁਣ ਪਲਾਸਟਿਕ ਦੀਆਂ ਬੋਤਲਾਂ ਦੇ ਗਮਲੇ ਬਣਾਉਂਦੇ ਹਨ ਮੈਂ ਉਹ ਵੀ ਘਰ ਤਿਆਰ ਕਰਦੀ ਹਾਂ ਅਤੇ ਫੁੱਲ ਵੀ ਲਗਾਉਂਦੀ ਹਾਂ ਅਤੇ ਮੈਨੂੰ ਇਸ ਤਰ੍ਹਾਂ ਸਬਜ਼ੀਆਂ ਵ ਵਗੈਰਾ ਲਗਾਉਣਾ ਦਾ ਵੀ ਬਹੁਤ ਸ਼ੌਕ ਹੈ ਧੰਨਵਾਦ